ਹਾਂਜੀ ਮੈਮ ਮੈਮ ਅਸੀਂ ਨਾ ਬੱਸ 'ਚ ਸਵਾਰੀ ਕਰ ਰਹੇ ਆ ਡਾਕਟਰ ਸਾਹਿਬ ਤੇ ਮੈਮ ਅਸੀਂ ਬੈਠੇ ਸੀ ਸੀਟ 'ਤੇ ਨਾ ਬੈਠਣ 'ਚ ਬਹੁਤ ਦਿੱਕਤ ਹੋ ਰਹੀ ਐ ਇੱਕ ਤਾਂ ਵਿੰਡੋ ਸੀਟ ਨਹੀਂ ਹੈਗੀ ਨਾ ਅਲੱਗ ਅਲੱਗ ਮਤਲਬ ਹੈਗੇ ਆ ਤੇ ਇੱਕ ਸੀਟ ਦੀ ਸੀਟਿੰਗ ਵੀ ਸਹੀ ਨਹੀਂ ਹੈਗੀ ਮੈਮ ਓਹ ਦਿੱਕਤ ਬਹੁਤ ਆ ਰਹੀ ਹ ਭੀੜ ਬਹੁਤ ਹੈ ਜੀ ਬਸ 'ਚ ਹਾਂਜੀ ਮੈਮ ਸੀਟ ਵੀ ਫਟੀ ਹੋਈ ਹੈ ਹਾਂਜੀ ਜਰੂਰ ਜੀ ਕਰੋ ਥੋੜੀ ਜੀ ਠੀਕ ਹੈ ਜੀ ਹਾਂਜੀ ਹਾਂਜੀ ਮੈਮ ਵਿੰਡੋ ਸੀਟ ਨੀ ਹੈਗੀ ਨਾ ਉਹਦੇ ਕਰਕੇ ਘੁਟਨ ਜੀ ਮਹਿਸੂਸ ਹੋ ਰਹੀ ਆ ਥੋੜਾ ਜਿਹਾ ਜਲਦੀ ਕਰ ਦਿਓ ਠੀਕ ਹ ਜੀ ਤੇ ਇਸ ਤੋਂ ਬਾਅਦ ਭੀੜ ਕਰਕੇ ਧੱਕਾ ਮੁੱਕੀ ਬਹੁਤ ਬੈਠਣ ਵੀ ਹੋ ਰਹੀ ਹੈ ਬਹੁਤ ਪਰੇਸ਼ਾਨੀ ਹਾਂਜੀ ਨਹੀਂ ਮੈਮ ਇਕ ਨਾ ਇਹ ਆਪਣੇ ਬਾਰੀ ਦੇ ਨਾਲ ਹੈਗੀ ਸੀਟ ਸਾਡੀ ਉਤਰਨ ਉਤਰਨ ਜਾਂ ਚੜਨ ਲੱਗਿਆ ਸਵਾਰੀਆ ਚ ਧੱਕਾ ਬਹੁਤ ਹੁੰਦਾ ਤਾਂ ਉਹਦੇ ਕਰਕੇ ਬਹੁਤ ਪ੍ਰੇਸ਼ਾਨੀ ਹੋ ਰਹੀ ਆ ਤੁਸੀਂ ਐਦਾਂ ਦੀ ਸੀਟ ਦਿਓ ਨਾ ਜਿੱਥੇ ਮਤਲਵ ਕੋਈ ਐਦਾਂ ਚੜਨ ਲੈਣ ਵੜੀ ਵਾਰੀ ਵਗੈਰਾ ਨਾ ਹੋਵੇ ਮੈਮ ਤਿੰਨ ਸੀਟ ਵਾਲੀ ਸਾਈਡ ਠੀਕ ਰਹਿ ਗਿਆ ਕਿਉਂਕਿ ਮੇਰੇ ਨਾਲ ਹੋਰ ਵੀ ਮੇਰੇ ਨਾਲ ਦੇ ਹੈਗੇ ਆ ਹਾਂਜੀ ਨਹੀਂ ਮੈਮ ਇਸ ਵਧੀਆ ਨਿਊ ਹੋਣੀਆਂ ਚਾਹੀਦੀਆਂ ਠੀਕ ਹੈ ਜੀ ਜੀ ਥੈਂਕ ਯੂ